ਉੱਨੀ ਅਕਤੂਬਰ ਉੱਨੀ ਸੌ ਸਤਾਨਵੇਂ ਵੀਹ ਜਨਵਰੀ ਦੋ ਹਜ਼ਾਰ ਦੋ ਪੰਦਰ੍ਹਾਂ ਅਕਤੂਬਰ ਦੋ ਹਜ਼ਾਰ ਤਿੰਨ ਛੱਬੀ ਫਰਵਰੀ ਦੋ ਹਜ਼ਾਰ ਸੌਲ੍ਹਾਂ ਪੰਜ ਸਤੰਬਰ ਦੋ ਹਜ਼ਾਰ ਅਠਾਰ੍ਹਾਂ